ਪੰਜਾਬ ਵਿੱਚ ਚਾਰ ਤਰ੍ਹਾਂ ਦੇ ਮੌਸਮ ਹੁੰਦੇ ਹਨ ਗਰਮੀ ਸਰਦੀ ਪਤਝੜ ਸੌਣ ਮੈਨੂੰ ਗਰਮੀ ਦਾ ਮੌਸਮ ਬਹੁਤ ਪਸੰਦ ਹੈ ਗਰਮੀ ਵਿੱਚ ਅਸੀਂ ਸਾਰੇ ਮਿਲ ਕੇ ਘੁੰਮਣ ਜਾਂਦੇ ਹਨ ਮੈਨੂੰ ਬੋਟਿੰਗ ਦਾ ਬੜਾ ਸ਼ੌਂਕ ਹੈ ਅਸੀਂ ਸਾਰੇ ਮਿਲ ਕੇ ਬੋਟਿੰਗ ਕਰਦੇ ਹਨ ਬੜਾ ਮਜ਼ਾ ਆਉਂਦਾ ਹੈ ਗਰਮੀ ਦੇ ਮੌਸਮ ਵਿੱਚ ਫਲ਼ ਬਹੁਤ ਤਰ੍ਹਾਂ ਦੇ ਹੁੰਦੇ ਹਨ ਅੰਬ ਮੇਰਾ ਮਨਪਸੰਦ ਫਲ਼ ਹੈ ਨਾਰੀਅਲ ਪਾਣੀ ਵੀ ਵਧੀਆ ਲੱਗਦਾ ਹੈ ਜੋ ਕਿ ਸਿਹਤ ਲਈ ਵੀ ਚੰਗਾ ਹੈ ਗਰਮੀ ਦੇ ਦਿਨ ਵੱਡੇ ਹੁੰਦੇ ਹਨ ਅਤੇ ਅਸੀਂ ਬਹੁਤ ਸਾਰਾ ਕੰਮ ਵੀ ਨਿਬੇੜ ਸਕਦੇ ਹਨ